ਹਾਂਜੀ ਹੈਲੋ ਹਾਂਜੀ ਅੰਜਲੀ ਵਧੀਆ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਬਸ ਜੀ ਕੁਛ ਨਹੀਂ ਹੋਰ ਕੀ ਚੱਲਦਾ ਬੱਚੇ ਠੀਕ ਨੇ ਸੀਤਾ ਕਿਵੇਂ ਆ ਅੱਛਾ ਅੱਛਾ ਅੱਛਾ ਹੋਰ ਸੁਣਾਓ ਅੱਜ ਬੜੇ ਦਿਨ ਬਾਅਦ ਫੋਨ ਕੀਤਾ ਅਨਹਦ ਠੀਕ ਹੈ ਵਧੀਆ ਬਸ ਹੁਣ ਬੱਚੇ ਵੱਡੇ ਹੋ ਗਏ ਸਕੂਲੋਂ ਆਉਂਦੇ ਆ ਪੜ੍ਹਾਈਆਂ ਪ੍ਰੈਸ਼ਰ ਹਾਂ ਹਾਂ ਹਾਂ ਅੱਛਾ ਹੋ ਗਈ ਆ ਉਹ ਠੀਕ ਹੈ ਠੀਕ ਹੈ ਅੱਛਾ ਅੱਛਾ ਅੱਛਾ ਠੀਕ ਹੈ ਕਿੱਥੇ ਸੋਚਿਆ ਫਿਰ ਕਿੱਥੇ ਲਗਾਉਣਾ ਓਕੇ ਓਕੇ ਹਾਂਜੀ ਹਾਂਜੀ ਵੈਸੇ ਤਾਂ ਦੇਖੋ ਸਾਰੇ ਸਕੂਲ ਹੀ ਆਪਣੀ ਜਗ੍ਹਾ 'ਤੇ ਵਧੀਆ ਨੇ ਅਤੇ ਇੱਥੇ ਆਪਣਾ ਦਸ਼ਮੇਸ਼ ਸਕੂਲ ਜਿਹੜਾ ਹੈਗਾ ਫਰੀਦਕੋਟ ਦਾ ਫੇਮਸ ਵਧੀਆ ਸਕੂਲ ਹੈ ਅਤੇ ਬਾਬਾ ਫਰੀਦ ਵੀ ਹੈਗਾ ਮਹਾਤਮਾ ਗਾਂਧੀ ਵੀ ਹੈਗਾ ਅਤੇ ਉੱਧਰ ਕੋਟਕਪੂਰਾ ਜਦੋਂ ਜਾਂਦੇ ਆ ਨਾ ਬਾਈਪਾਸ ਅਤੇ ਉਦੋਂ ਦਿੱਲੀ ਇੰਟਰਨੈਸ਼ਨਲ ਸਕੂਲ ਪੈਂਦਾ ਇੱਕ ਮਾਊਂਟ ਲੀਟਰਾ ਵੀ ਹੈਗਾ ਹਾਂਜੀ ਆਹਮਣੇ ਸਾਹਮਣੇ ਆ ਦੋਵੇਂ ਅਤੇ ਉੱਥੇ ਵੀ ਹੈਗੇ ਬੱਚੇ ਵੀ ਵਧੀਆ ਪੜ੍ਹਦੇ ਹੈਗੇ ਆ ਸਾਰੇ ਬਾਕੀ ਟੀਚਰ ਸਟੱਡੀ ਤਾਂ ਦੇਖੋ ਜੀ ਸਾਰੀ ਜਗ੍ਹਾ 'ਤੇ ਵਧੀਆ ਹੈਗੀ ਆ ਅਤੇ ਬਾਕੀ ਕੁਛ ਕੁ ਬੱਚਿਆਂ ਦੇ ਉੱਤੇ ਵੀ ਡਿਪੈਂਡ ਕਰਦਾ ਵੀ ਕਿਵੇਂ ਬੱਚੇ ਪੜ੍ਹਦੇ ਹੈਗੇ ਆਪਣੇ ਕਿਵੇਂ ਅਧਿਆਪਕ ਪੜ੍ਹਾਉਂਦੇ ਕਰਦੇ ਆ ਹਾਂਜੀ ਹਾਂਜੀ ਹਾਂਜੀ ਅਤੇ ਆਪਣਾ ਦਸ਼ਮੇਸ਼ ਸਕੂਲ ਵੀ ਬਹੁਤ ਵਧੀਆ ਇੱਥੋਂ ਦੇ ਜਿਹੜੇ ਅਧਿਆਪਕ ਆ ਸਾਰੇ ਸਾਰੇ ਵਧੀਆ ਪੜ੍ਹੇ ਲਿਖੇ ਅਤੇ ਸਮਝਦਾਰ ਨੇ ਬੱਚਿਆਂ ਨੂੰ ਕਿਵੇਂ ਸਮਝਾਉਣਾ ਛੋਟੇ ਬੱਚਿਆਂ ਨੂੰ ਕਿਵੇਂ ਹੈਂਡਲ ਕਰਨਾ ਅਤੇ ਸਾਰਾ ਕੁਛ ਆਉਂਦਾ ਉਹਨਾਂ ਨੂੰ ਹੈ ਨਾ ਅਤੇ ਪਿਆਰ ਨਾਲ ਬਾਕੀ ਖੇਡਾਂ ਅੱਜ ਕੱਲ੍ਹ ਖੇਡਾਂ ਕਰਾਉਂਦੇ ਹੈਗੇ ਆ ਬੱਚਿਆਂ ਨੂੰ ਜੇ ਟੈਕਨੋਲੋਜੀ ਇਸ ਪੱਧਰ 'ਤੇ ਪਹੁੰਚ ਗਈ ਹਾਂਜੀ ਹਾਂਜੀ ਅਤੇ ਇੱਥੇ ਤਾਂ ਸਾਰੀਆਂ ਸੁਵਿਧਾਵਾਂ ਹੈਗੀਆਂ ਬੱਚਿਆਂ ਵਾਸਤੇ ਵੈਨ ਬੱਸ ਦੀ ਸਹੂਲੀਅਤ ਵੀ ਹੈਗੀ ਹੈ ਅਤੇ ਬਾਕੀ ਇਹ ਕਿ ਮੈਡੀਕਲ ਦੀਆਂ ਵੀ ਕੋਈ ਵੀ ਬੱਚਾ ਕਦੇ ਬਿਮਾਰ ਹੋਜੇ ਜਾਂ ਕੋਈ ਚੋਟ ਲੱਗ ਜੇ ਅਤੇ ਅੰਦਰ ਹੀ ਉਹਨਾਂ ਨੇ ਪੂਰੀ ਫੈਸਿਲਿਟੀ ਦਿੱਤੀ ਹੋਈ ਹੈਗੀ ਹੈ ਅਨਹਦ ਤਾਂ ਸ਼ੁਰੂ ਤੋਂ ਹੀ ਉੱਥੇ ਪੜ੍ਹਿਆ ਅਤੇ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਵੀ ਇੱਥੇ ਵੀ ਲਗਾ ਸਕਦੇ ਹੋ ਬੱਚੇ ਨੂੰ ਅਨਹਦ ਤਾਂ ਜੀ ਹੁਣ ਤੀਸਰੀ ਕਲਾਸ 'ਚ ਆਉਣਾ ਆਵੇਗਾ ਅਗਲੇ ਸਾਲ ਸੈਕਿੰਡ ਦੇ ਵਿੱਚ ਦੂਸਰੀ ਕਲਾਸ 'ਚ ਪੜ੍ਹਦਾ ਹੁਣ ਅਤੇ ਹਾਂਜੀ ਹਾਂਜੀ ਅਤੇ ਬਾਕੀ ਇਹ ਸ਼ੁਰੂ ਤੋਂ ਇੱਥੇ ਗਿਆ ਇੱਥੋਂ ਦੇ ਸਾਰੇ ਅਧਿਆਪਕ ਬਹੁਤ ਵਧੀਆ ਹੈਗੇ ਨੇ ਅਤੇ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਉਹਨੂੰ ਹਾਂਜੀ ਕੇਂਦਰੀ ਵਿਦਿਆਲੇ ਵੀ ਕੇਂਦਰੀ ਵਿਦਿਆਲੇ ਵੀ ਬੜਾ ਵਧੀਆ ਜੀ ਵੈਸੇ ਤਾਂ ਅਤੇ ਹਜੇ ਤਾਂ ਕੁੜੀਆਂ ਛੋਟੀ ਆ ਅਤੇ ਇਹਨੂੰ ਲੈ ਵੀ ਬਾਕੀ ਉੱਥੇ ਪਹਿਲਾਂ ਹਾਂਜੀ ਹਾਂਜੀ ਛੋਟੀ ਹੈ ਹਜੇ ਬਾਕੀ ਤੁਹਾਡੇ ਘਰ ਦੇ ਨੇੜੇ ਹੈ ਬਾਬਾ ਫਰੀਦ ਜੀ ਤੁਹਾਡੇ ਘਰ ਦੇ ਨੇੜੇ ਪੈ ਜਾਂਦਾ ਤੁਸੀਂ ਬਾਬਾ ਫਰੀਦ ਦੇ ਵਿੱਚ ਵੀ ਲਗਾ ਸਕਦੇ ਹੋ ਹਾਂਜੀ ਹਾਂਜੀ ਉੱਥੇ ਵੀ ਲਗਾ ਸਕਦੇ ਹੋ ਉੱਥੇ ਵੀ ਵਧੀਆ ਨੇ ਸਾਰੇ ਹਾਂਜੀ ਹਾਂ ਹਾਂ ਹਾਂ ਹਾਂਜੀ ਇਹ ਤਾਂ ਹੈ ਮਾਹੌਲ ਜੀ ਸਾਰੇ ਪਾਸੇ ਹੀ ਬਾਕੀ ਵਿਗੜਿਆ ਹੋਇਆ ਵੀ ਹੈ ਬਾਕੀ ਇਹ ਕਿ ਚਲੋ ਆਪਾਂ ਆਪਣੇ ਬੱਚਿਆਂ ਨੂੰ ਜਿਵੇਂ ਲੈ ਕੇ ਚਲਦੇ ਹਾਂ ਆਪਾਂ ਨੂੰ ਹੈ ਵੀ ਅਧਿਆਪਕ ਵੀ ਉਵੇਂ ਲੈ ਕੇ ਚੱਲਣ ਅਤੇ ਹਾਂਜੀ ਹਾਂਜੀ ਹਾਂਜੀ ਬਾਕੀ ਇਥੋਂ ਦੇ ਏ ਜਿਹੜੇ ਪ੍ਰਿੰਸੀਪਲ ਹੈਗੇ ਉਹ ਵੀ ਬਹੁਤ ਵਧੀਆ ਨੇ ਸਰਦਾਰ ਨੇ ਉਹ ਅਤੇ ਬਹੁਤ ਹਾਂਜੀ ਹਾਂਜੀ ਬਹੁਤ ਨਾਮ ਹੈ ਉਹਨਾਂ ਦਾ ਤੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਾਰੇ ਇਹ ਵੀ ਕੰਮ ਹੁੰਦੇ ਹੈਗੇ ਆ ਬੱਚਿਆਂ ਦਾ ਕੇਅਰ ਪੂਰੀ ਚੰਗੇ ਤਰੀਕੇ ਨਾਲ ਬੱਚਿਆਂ ਦੀ ਦੇਖ ਰੇਖ ਹੁੰਦੀ ਹੈ ਕੋਈ ਵੀ ਨਿਗਰਾਨੀ 'ਚੋਂ ਬਾਹਰ ਨਹੀਂ ਹਾਂਜੀ ਅਤੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਭ ਜਗ੍ਹਾ 'ਤੇ ਜੀ ਅਤੇ ਜੀ ਜੀ ਜ਼ਰੂਰ ਜ਼ਰੂਰ ਬਾਕੀ ਮੇਰੇ ਹਿਸਾਬ ਨਾਲ ਤਾਂ ਮੈਨੂੰ ਸਕੂਲ ਇਹ ਬਹੁਤ ਵਧੀਆ ਲੱਗਦਾ ਦਸ਼ਮੇਸ਼ ਸਕੂਲ ਇੱਕ ਵਾਰ ਤੁਸੀਂ ਜਾ ਕੇ ਆਓ ਤੁਸੀਂ ਦੇਖੋ ਬੱਚੇ ਉਥੇ ਅਧਿਆਪਕਾਂ ਨੂੰ ਮਿਲੋ ਤੁਸੀਂ ਤੇ ਉੱਥੇ ਤੁਹਾਨੂੰ ਜਾ ਕੇ ਪਤਾ ਚੱਲ ਜੁਗਾ ਬਾਕੀ ਫੀਸ ਸਟਰਕਚਰ ਉਹਨਾਂ ਦਾ ਸਾਰਾ ਕੁਛ ਉਹ ਦੱਸ ਦੇਣਗੇ ਅਤੇ ਇੱਕ ਵਾਰੀ ਗੱਲ ਕਰ ਲਓ ਦਸੰਬਰ ਦੇ ਵਿੱਚ ਐਡਮਿਸ਼ਨ ਨਿਊ ਐਡਮਿਸ਼ਨ ਲੈਣੀ ਸ਼ੁਰੂ ਕਰ ਦਿੰਦੇ ਹੈਗੇ ਆ ਹਾਂਜੀ ਹਾਂਜੀ ਹਾਂਜੀ ਅਤੇ ਪਲੇਅਵੇਅ ਵਿੱਚ ਪਹਿਲਾਂ ਤਾਂ ਬੱਚਿਆਂ ਨੂੰ ਖਿਡਾਉਣਗੇ ਹੀ ਛੋਟੇ ਬੱਚਿਆਂ ਨੂੰ ਤਾਂ ਪੜ੍ਹਾਈ ਦਾ ਤਾਂ ਕੁਛ ਹੁੰਦਾ ਹੀ ਨਹੀਂ ਹਾਂ ਹਾਂਜੀ ਹਾਂਜੀ ਨਹੀਂ ਹਾਂ ਇਹ ਤਾਂ ਜੀ ਸਾਰਾ ਕੁਛ ਇੱਥੇ ਅਤੇ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਵਧੀਆ ਤੁਸੀਂ ਇੱਥੇ ਆਓ ਇੱਕ ਵਾਰੀ ਤੁਸੀਂ ਮੈਨੂੰ ਕਦੇ ਵੀ ਫੋਨ ਕਰਦੇ ਹੋ ਅਤੇ ਮੈਂ ਤੁਹਾਡੇ ਨਾਲ ਚੱਲ ਵੜੂੰਗੀ ਅਤੇ ਫਿਰ ਆਪਾਂ ਜਾ

ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਠੀਕ ਹੈ ਜੀ ਓਕੇ ਧੰਨਵਾਦ ਜੀ ਧੰਨਵਾਦ